ਹਾਂਜੀ ਮੈਂ ਡੈਲ ਦਾ ਲੈਪਟੋਪ ਮੰਗਵਾਇਆ ਸੀ ਫਲਿੱਪਕਾਟ ਤੋਂ ਅਤੇ ਪਹਿਲਾਂ ਤਾਂ ਉਹਨਾਂ ਦੀ ਡਿਲੀਵਰੀ ਹੀ ਬਹੁਤ ਮੇਰੇ ਤੱਕ ਲੇਟ ਆਈ ਆ ਠੀਕ ਹੈ ਕਿ ਕਾਫੀ ਮੈਨੂੰ ਮੈਨੂੰ ਉਹਨਾਂ ਨੇ ਮਤਲਬ ਮੇਰੇ ਜ ਜਦੋਂ ਮੈਂ ਔਡਰ ਕੀਤਾ ਸੀ ਅਤੇ ਉ ਉਹ 'ਚ ਲਿਖਿਆ ਹੋਇਆ ਸੀ ਕਿ ਤੁਹਾਨੂੰ ਮ ਪ ਹਫਤੇ ਦੇ ਵਿੱਚ ਵਿੱਚ ਪਹੁੰਚ ਜਾਵੇਗਾ ਲੇਕਿਨ ਮੇਰੇ ਕੋਲ ਆਉਂਦੇ ਆਉਂਦੇ ਉਹਨੂੰ ਪੰਦਰਾਂ ਦਿਨ ਲੱਗ ਗਏ ਚਲੋ ਉਸ ਤੋਂ ਬਾਅਦ ਜਿਹੜਾ ਡਿਲੀਵਰੀ ਕਰ ਰਿਹਾ ਸੀ ਉਹਦਾ ਬਿਹੇਵੀਅਰ ਇੰਨਾ ਕੁ ਗੰਦਾ ਸੀ ਕਿ ਮੈਂ ਤੁਹਾਨੂੰ ਉਹਨੇ ਬਹੁਤ ਰੂੜ ਬਿਹੇਵੀਅਰ ਕੀਤਾ ਕਿ ਫਿਰ ਚਲੋ ਮੈਨੂੰ ਦੇ ਤਾਂ ਗਿਆ ਉਸ ਤੋਂ ਬਾਅਦ ਜਦੋਂ ਜਦੋਂ ਮੈਂ ਖੋਲ੍ਹਿਆ ਤਾਂ ਉਹਦੀ ਸਕਰੀਨ ਵੀ ਡੈਮੇਜ ਸੀ ਅਤੇ ਉਹਦੀ ਸਾਊਂਡ ਕੁਆਲਿਟੀ ਇੰਨੀ ਬੈਡ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅਤੇ ਮੇਰਾ ਤਾਂ ਇਹ ਇੰਨਾ ਬੈਡ ਐਕਸਪੀਰੀਅੰਸ ਰਿਹਾ ਹੈ ਕਿ ਮੈਂ ਮੈਂ ਇਸ ਬਾਰੇ ਕੀ ਕਹਾਂ ਮੈਂ ਤਾਂ ਕਹਿੰਦੀ ਕਿ ਔਨਲਾਈਨ ਕੋਈ ਚੀਜ਼ ਜਿਵੇਂ ਮੰਗਾਉਣੀ ਹੀ ਨਹੀਂ ਚਾਹੀਦੀ ਇਸ ਤਰੀਕੇ ਦੀ ਉਹਦੀ ਸਾਊਂਡ ਕੁਆਲਿਟੀ ਅਤੇ ਮੈਨੂੰ ਬਹੁਤ ਹੀ ਖਰਾਬ ਲੱਗੀ ਕਿਉਂ ਇ ਇਸ ਦੇ ਨਾਲ ਤਾਂ ਮੇਰਾ ਕੰਮ ਜਿਹੜਾ ਸੀ ਉਹ ਬਹੁਤ ਜ਼ਿਆਦਾ ਰੁਕ ਗਿਆ ਅਤੇ ਮੈਂ ਮੇਰਾ ਮੈਂ ਤਾਂ ਇਸ ਲਈ ਮੰਗਵਾਇਆ ਸੀ ਕਿ ਚਲੋ ਮੈਂ ਆਪ ਮੇਰਾ ਬੁਟੀਕ ਦਾ ਕੰਮ ਆ ਚਲੋ ਮੈਂ ਆਪਣੀ ਡਿਜ਼ਾਇਨਿੰਗ ਅ ਅੱਛੀ ਕਰ ਸਕਾਂ ਅਤੇ ਆਪਣਾ ਸੋਸ਼ਲ ਮੀਡੀਆ 'ਚ ਆਪਣਾ ਜਿਹੜਾ ਜਿਹੜਾ ਕੰਮ ਜਿਹੜਾ ਇਹ ਹੋਰ ਫੈਲਾ ਸਕਾਂ ਪਰ ਇਸਨੇ ਤਾਂ ਮੇਰਾ ਕੰਮ ਹੀ ਲੇਟ ਕਰਾ ਦਿੱਤਾ ਮੈਂ ਤਾਂ ਆਪਣੇ ਕਸਟਮਰਾਂ ਨੂੰ ਵੀ ਕਿਹਾ ਹੋਇਆ ਸੀ ਕਿ ਮੇਰੀ ਇੱਕ ਨਵੀਂ ਜੋ ਹੈ ਉਹ ਸੋਸ਼ਲ ਮੀਡੀਆ 'ਚ ਐਪ ਆਉਣੀ ਆ ਜਿਹੜੀ ਤੁਸੀਂ ਵੀ ਲਿੰਕ ਕਰਿਓ ਅਤੇ ਉਹਦੇ 'ਚ ਤੁਹਾਨੂੰ ਨਵੀਂ ਨਵੀਂ ਚੀਜ਼ਾਂ ਜੋ ਹੈ ਵੇਖਣ ਨੂੰ ਮਿਲਣਗੀਆਂ ਤੁਸੀਂ ਉਸ ਤਰੂ ਉਸ ਥਰੂ ਮੈਨੂੰ ਔਡਰ ਦੇਣਾ ਪਰ ਇਸ ਲੈਪਟੋਪ ਨੇ ਤਾਂ ਮੇਰਾ ਸਾਰਾ ਕੰਮ ਹੀ ਖਰਾਬ ਕਰ ਦਿੱਤਾ ਚਲੋ ਮੇਰੀ ਤਾਂ ਹੁਣ ਇਹੀ ਰਿਕੁਐਸਟ ਆ ਕਿ ਪਲੀਜ਼ ਇਹਨੂੰ ਵਾਪਸ ਕਰਕੇ ਅਤੇ ਮੈਨੂੰ ਕੋਈ ਨਵਾਂ ਲੈਪਟੋਪ ਪ੍ਰੋਵਾਈਡ ਕੀਤਾ ਜਾਵੇ ਤਾਂ ਜੋ ਜਿਹੜਾ ਮੇਰਾ ਕੰਮ ਰੁਕਿਆ ਹੋਇਆ ਹੈ ਉਹ ਮੈਂ ਆਪਣਾ ਕੰਮ ਜੋ ਹੈ ਉਹ ਚਲਾ ਸਕਾਂ ਅਤੇ ਆਪਣੀ ਲਾਈਫ ਜਿਹੜੀ ਉਹ ਅੱਗੇ ਵਧਾ ਸਕਾਂ